ਹੈਲੋ ਸਤਿ ਸ਼੍ਰੀ ਅਕਾਲ ਹੋਰ ਰਵੀਨਾ ਕਿਵੇਂ ਆ ਹਾਂ ਮੈਂ ਵੀ ਵਧੀਆ ਬਸ ਵਧੀਆ ਬੋਰਡ ਜਾਣ ਵਾਲੇ ਆ ਤੂੰ ਦੱਸ ਤੇਰੀ ਕਾਲਜ ਲਾਈਫ ਕਿਵੇਂ ਚੱਲਦੀ ਹੈ ਅੱਛਾ ਤੂੰ ਹੁਣ ਕਿਹੜਾ ਕੋਰਸ ਲਿਆ ਹੈ ਅੱਛਾ ਵਧੀਆ ਉਹ ਅੱਛਾ ਅਤੇ ਯਾਰ ਮੈਂ ਨਾ ਉਹ ਪੁੱਛਣਾ ਸੀ ਕਿ ਹੁਣ ਜਿਵੇਂ ਮੈਨੂੰ ਫਰੀਦਕੋਟ 'ਚ ਆਏ ਚਾਰ ਪੰਜ ਸਾਲ ਹੀ ਹੋਏ ਆ ਤਾਂ ਮੈਨੂੰ ਇੰਨਾ ਪ ਇੰਨਾ ਪਤਾ ਵੀ ਨਹੀਂ ਹੈਗਾ ਫਰੀਦਕੋਟ ਦਾ ਅਤੇ ਫਿਰ ਮੈਂ ਜਿਵੇਂ ਇੱਥੇ ਨਾਨ ਮੈਡੀਕਲ ਰੱਖੀ ਆ ਅਤੇ ਅੱਗੇ ਫਿਰ ਮੈਂ ਕੀ ਕਰਾਂ ਮੈਨੂੰ ਜੋਬ ਦੇ ਮੌਕੇ ਮਿਲ ਸਕਦੇ ਆ ਵਧੀਆ ਕਿ ਨਹੀਂ ਮੇਰਾ ਵੈਸੇ ਟੀਚਿੰਗ 'ਚ ਜ਼ਿਆਦਾ ਹੈ ਮੈਂ ਮੈਥ 'ਚ ਜ਼ਿਆਦਾ ਰੱਖਦੀ ਹਾਂ ਅੱਛਾ ਅੱਛਾ ਤੇ ਫਿ ਇ ਜੇ ਫਿਰ ਮੈਂ ਇੱਥੇ ਆਪਣੀਆਂ ਟਿਊਸ਼ਨ ਦਾ ਕਰਾਂ ਤਾਂ ਸੈਟਲ ਹੋਵਾ ਕਿ ਨਹੀਂ ਇਹ ਹੋਰ ਕਿਵੇਂ ਅੱਛਾ ਠੀਕ ਹੈ ਧੰਨਵਾਦ